ਕਾਰੋਬਾਰ ਦੇ ਵਿਕਾਸ ਵਾਸਤੇ ਆਪਾਂ ਅੱਜ ਕੱਲ੍ਹ ਸੋਸ਼ਲ ਮੀਡੀਆ ਦਾ ਯੂਜ ਕਰ ਸਕਦੇ ਹਾਂ ਮਾਰਕਟਿੰਗ ਕਹਿ ਸਕਦੇ ਹਾਂ ਆਪਾਂ ਜਿਸ ਦੇ ਵਿੱਚ ਕੀ ਹੈ ਆਪਾਂ ਆਪਣੇ ਬਣਾਏ ਗਏ ਜੋ ਵੀ ਪ੍ਰੋਡਕਟ ਹੈ ਜਾਂ ਜੋ ਵੀ ਆਪਣੇ ਚੀਜ਼ ਹੈ ਉਸ ਨੂੰ ਮਾਰਕੀਟ ਦੇ ਵਿੱਚ ਆਪਾਂ ਦਿਖਾ ਸਕਦੇ ਹਾਂ ਕਿ ਸਾਡੀ ਇਹ ਚੀਜ਼ ਇਸ ਦੀ ਵਰਤੋਂ ਵਾਸਤੇ ਹੈ ਇਸ ਨੂੰ ਹੋਰ ਵੱਡੇ ਸਕੇਲ 'ਤੇ ਲੈ ਕੇ ਜਾਣ ਵਾਸਤੇ ਆਪਾਂ ਇਹ ਬਾਹਰ ਦੀਆਂ ਕੰਪਨੀਆਂ ਨਾਲ ਆਪਾਂ ਕੰਟੈਕਟ ਕਰ ਸਕਦੇ ਹਾਂ ਜਿੱਦਾਂ ਕਿਸੇ ਕਿਸੇ ਵੀ ਬਾਹਰ ਦੀ ਕੰਪਨੀ ਨੂੰ ਕੋਈ ਵੀ ਚੀਜ਼ ਦੀ ਲੋੜ ਹੈ ਤਾਂ ਆਪਾਂ ਉਹ ਚੀਜ਼ ਨੂੰ ਸਪਲਾਈ ਕਰ ਸਕਦੇ ਹਾਂ ਜਿਵੇਂ ਦੁਬਈ ਦੇ ਵਿੱਚ ਸਿਰਫ ਤੇਲ ਦਾ ਉਤਪਾਦਨ ਹੁੰਦਾ ਉੱਥੇ ਬਾਕੀ ਚੀਜ਼ਾਂ ਦੀ ਲੋੜ ਹੈ ਆਪਾਂ ਆਪਣੀ ਬਣਾਈ ਹੋਈ ਚੀਜ਼ ਨੂੰ ਉੱਥੇ ਤੱਕ ਪਹੁੰਚਾ ਸਕਦੇ ਹਾਂ ਇੱਕ ਵਧੀਆ ਮਾਰਕੀਟ ਦੇ ਵਿੱਚ ਕਿਸੇ ਵੀ ਸਹਿਯੋਗੀ ਨਾਲ ਵਧੀਆ ਰਿਸ਼ਤਾ ਬਣਾ ਕੇ ਤਾਂ ਕਿ ਕੱਲ ਨੂੰ ਜੇਕਰ ਕਿਤੇ ਜ਼ਰੂਰਤ ਪਏ ਤਾਂ ਆਪਾਂ ਉਸ ਦੀ ਮਦਦ ਲੈ ਕੇ ਆਪਣੀ ਬਣਾਈ ਗਈ ਚੀਜ਼ ਨੂੰ ਅੱਗੇ ਲੈ ਕੇ ਆ ਸਕਦੇ ਹਾਂ